ਅੱਜ ਦੇ ਚਮਕ ਦਮਕ ਵਾਲੇ ਯੁੱਗ ਦੇ ਵਿੱਚ ਬੜਾ ਹੀ ਮੁਸ਼ਕਿਲ ਹੈ ਕਿ ਕਿਸੇ ਨੂੰ ਕੋਈ ਸੰਗੀਤਕਾਰ ਕੋਈ ਸੂਫੀ ਜਾਂ ਫਿਰ ਕੋਈ ਜੋ ਰੱਬੀ ਗੀਤ ਗਾਉਂਦਾ ਹੋਵੇ ਉਹ ਪਸੰਦ ਆਵੇ ਮੈਨੂੰ ਜਿਵੇਂ ਕਿ ਮੈਂ ਥੋੜ੍ਹੇ ਪੁਰਾਣੇ ਜ਼ਮਾਨੇ ਦੀ ਆਪਣੇ ਆਪ ਨੂੰ ਸੋਚ ਸਕਦੀ ਹਾਂ ਕਿ ਮੈਨੂੰ ਪਸੰਦ ਹੈ ਗੁਰਦਾਸ ਮਾਨ ਜੀ ਅਤੇ ਸਤਿੰਦਰ ਸਰਤਾਜ ਮੈਨੂੰ ਇਹ ਦੋਨੋਂ ਹੀ ਗਾਇਕ ਬਹੁਤ ਪਸੰਦ ਨੇ ਕਿਉਂਕਿ ਦੋਨਾਂ ਦੀ ਗਾਇਕੀ ਬਿਲਕੁਲ ਹੀ ਇੱਕ ਜਿਹੀ ਲੱਗਦੀ ਹੈ ਮੈਨੂੰ ਦੋਵਾਂ ਨੂੰ ਦੋਵਾਂ ਨੂੰ ਤਾਂ ਮੈਂ ਨਹੀਂ ਕਵਾਂਗੀ ਗੁਰਦਾਸ ਮਾਨ ਸਾਹਿਬ ਜੀ ਨੂੰ ਰੱਬ ਮੰਨਿਆ ਜਾਂਦਾ ਉਹ ਬਹੁਤ ਹੀ ਵਧੀਆ ਗਾਉਂਦੇ ਨੇ ਉਹ ਇਸ ਹਿਸਾਬ ਨਾਲ ਗਾਉਂਦੇ ਨੇ ਕਿ ਬੰਦਾ ਰੱਬ ਨਾਲ ਜੁੜ ਜਾਂਦਾ ਉਹ ਰੱਬ ਨਾਲ ਜੁੜੀਆਂ ਹੀ ਗੱਲਾਂ ਕਰਦੇ ਨੇ ਉਸੇ ਤਰ੍ਹਾਂ ਨਾਲ ਸਤਿੰਦਰ ਸਰਤਾਜ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਗਾਇਕੀ ਦੇ ਵਿੱਚ ਲੱਚਰਤਾ ਬਿਲਕੁਲ ਨਹੀਂ ਝਲਕਦੀ ਜਿੰਨਾਂ ਉਹ ਵਧੀਆ ਗਾਉਂਦੇ ਨੇ ਉਨੇ ਹੀ ਉਹ ਵਧੀਆ ਇਨਸਾਨ ਵੀ ਨੇ ਅਤੇ ਇਹ ਦੋਵੇਂ ਹੀ ਸਿੰਗਰ ਮੈਨੂੰ ਬੜੇ ਹੀ ਅਜ਼ੀਜ਼ ਨੇ ਔਰ ਮੈਨੂੰ ਸਭ ਤੋਂ ਜ਼ਿਆਦਾ ਕਰੀਬੀ ਇਹੀ ਲੱਗਦੇ ਨੇ ਕਿ ਜਿਵੇਂ ਅਸੀਂ ਕਿਸੇ ਵੀ ਤਰ੍ਹਾਂ ਦੇ ਸੋਚ ਦੇ ਵਿੱਚ ਡੁੱਬੇ ਹੋਈਏ ਅਤੇ ਅਗਰ ਅਸੀਂ ਉਹਨਾਂ ਦਾ ਕੋਈ ਗਾਣਾ ਸੁਣ ਲਈਏ ਤਾਂ ਇੱਦਾਂ ਲੱਗਦਾ ਜਿਵੇਂ ਮਨ ਸ਼ਾਂਤ ਹੋ ਗਿਆ ਇਹ ਮੇਰੇ ਦੋਨੋਂ ਹੀ ਬਹੁਤ ਵਧੀਆ ਸਿੰਗਰ ਨੇ ਔਰ ਬਚਪਨ ਤੋਂ ਮੈਂ ਗੁਰਦਾਸ ਮਾਨ ਜੀ ਨੂੰ ਸੁਣਦੀ ਆ ਰਹੀ ਸੀ ਜਿਵੇਂ ਥੋੜ੍ਹੀ ਵੱਡੀ ਹੋਈ ਸਕੂਲ ਕਾਲਜ ਦੇ ਵਿੱਚ ਜਦੋਂ ਜਾਣਾ ਸ਼ੁਰੂ ਕੀਤਾ ਤਾਂ ਸਤਿੰਦਰ ਸਰਤਾਜ ਜੀ ਨੂੰ ਸੁਣਿਆ ਅੱਜ ਦੇ ਟਾਈਮ ਦੇ ਵਿੱਚ ਦੋਹੇ ਸਿੰਗਰ ਇੰਨੇ ਵਧੀਆ ਨੇ ਸੂਫੀਆਨਾ ਗਾਉਂਦੇ ਨੇ ਰੱਬ ਨਾਲ ਜੁੜਨ ਵਾਲੀਆਂ ਗੱਲਾਂ ਕਰਦੇ ਨੇ ਔਰ ਬੇਸ਼ੱਕ ਹੀ ਇਹਨਾਂ ਤੋਂ ਉੱਤੇ ਮੈਂ ਕਿਸੇ ਵੀ ਸਿੰਗਰ ਨੂੰ ਨਹੀਂ ਮੰਨਦੀ ਧੰਨਵਾਦ